ਕਾਨੂੰਨੀ ਦਸਤਾਵੇਜ ਬਣਾਉਣ ਦਾ ਮੇਰਾ ਤਾਂ ਮਤਲਬ ਮੰਨਣਾ ਇਹੀ ਹੈ ਕਿ ਕਾਫੀ ਖੱਜਲ ਖਰਾਬੀ ਅਤੇ ਦੌੜ ਭੱਜ ਵਾਲਾ ਕੰਮ ਆਪਣੀ ਗੱਲ ਕਰਾਂ ਤਾਂ ਜਦੋਂ ਮਤਲਬ ਆਪਣਾ ਆਧਾਰ ਕਾਰਡ ਅਪਡੇਟ ਕਰਵਾਇਆ ਸੀ ਅਤੇ ਪੈਨ ਕਾਰਡ ਅਪਲਾਈ ਕਰਵਾਇਆ ਸੀ ਅਤੇ ਕੁੱਝ ਮਤਲਬ ਜਿੱਦਾਂ ਬੈਂਕ ਅਕਾਊਂਟ ਵਗੈਰਾ ਅਤੇ ਕੁੱਝ ਹੋਰ ਵੀ ਸਰਕਾਰੀ ਦਸਤਾਵੇਜ ਜਦੋਂ ਬਣਾਉਣ ਲਈ ਮੈਂ ਪਹੁੰਚਦਾ ਸੀ ਤਾਂ ਮਤਲਬ ਕਾਫੀ ਦੌੜ ਭੱਜ ਖੱਜਲ ਖਰਾਬੀ ਵਾਲਾ ਕੰਮ ਹੁੰਦਾ ਰਿਹਾ ਕਦੇ ਸਰਪੰਚ ਦੇ ਸਾਈਨ ਕਰਵਾਓ ਕਦੇ ਉਹਦੇ ਪਟਵਾਰੀ ਦੇ ਸਾਈਨ ਕਰਾਓ ਅਤੇ ਇਸੇ ਚੀਜ਼ ਨੂੰ ਮੈਂ ਮਤਲਬ ਸਮਝਦਾ ਕਿ ਚਲੋ ਸਰਕਾਰੀ ਚੀਜ਼ ਅਤੇ ਸੁਰੱਖਿਆ ਨੂੰ ਵੀ ਮੱਦੇ ਨਜ਼ਰ ਰੱਖਦੇ ਆ ਲੇਕਿਨ ਜਿੱਦਾਂ ਡਿਜੀਟਲ ਦਾ ਜਮਾਨਾ ਆ ਰਿਹਾ ਅਤੇ ਹਰ ਚੀਜ਼ ਨੂੰ ਮਤਲਬ ਸਿੰਪਲ ਅਤੇ ਸੌਖਾ ਕੀਤਾ ਜਾ ਰਿਹਾ ਅਤੇ ਮੇਰਾ ਮੰਨਨਾ ਇਹੀ ਹੈ ਕਿ ਇਸ ਚੀਜ਼ 'ਤੇ ਵੀ ਕੋਈ ਮਤਲਬ ਇੱਦਾਂ ਦੀ ਟੈਕਨੋਲੋਜੀ ਲਿਆਂਦੀ ਜਾਵੇਗੀ ਹਰ ਇੱਕ ਜੋ ਵੀ ਕੰਮ ਹੈਗਾ ਇੱਦਾਂ ਸਰਕਾਰੀ ਦਸਤਾਵੇਜ ਬਣਾਉਣ ਦਾ ਉਹ ਇੱਕੋ ਛੱਤ ਦੇ ਥੱਲੇ ਕੀਤਾ ਜਾ ਸਕੇ ਜਿਸ ਕਾਰਨ ਜਿਹੜੀ ਲੋਕਾਂ ਦੀ ਦੌੜ ਭੱਜ ਅਤੇ ਜਿਹੜਾ ਟਾਈਮ ਜਿਹੜਾ ਬਰਬਾਦ ਜਾਂਦਾ ਸਮਾਂ ਬਰਬਾਦ ਜਾਂਦਾ ਉਹਨੂੰ ਉਹਨੂੰ ਬਚਾਇਆ ਜਾ ਸਕੇ ਅਤੇ ਜਲਦੀ ਤੋਂ ਜਲਦੀ ਕੰਮ ਕੀਤਾ ਜਾ ਸਕੇ